ਮੈਂ ਬਹੁਤ ਸਾਰੀ ਕਿਸਮ ਦੀ ਪੌਦੇ ਅਤੇ ਵੇਲ੍ਹਾਂ ਵਾਲੀਆਂ ਸਬਜ਼ੀਆਂ ਉਗਾਉਂਦਾ ਹਨ ਜਿਨ੍ਹਾਂ ਵਿੱਚੋਂ ਵੇਲ੍ਹਾਂ ਵਾਲੀਆਂ ਸਬਜ਼ੀਆਂ ਹਨ ਕੱਦੂ ਕਰੇਲਾ ਤੋਰੀ ਟਮਾਟਰ ਖੀਰਾ ਘੀਆ ਅਤੇ ਪੌਦੇ ਵਾਲੀਆਂ ਸਬਜ਼ੀਆਂ ਹਨ ਜਿਵੇਂ ਕਿ ਭਿੰਡੀ ਸ਼ਿਮਲਾ ਮਿਰਚ ਨਿੰਬੂ ਆਦਿ